ਭਾਰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਵਿਅਕਤੀ ਲਈ ਸਾਡੇ ਪਿੰਡ ਵਿੱਚ ਘਰੇਲੂ ਉਪਚਾਰ ਦਿੰਦੇ ਹਨ ਜਿਵੇਂ ਕਿ ਜੇ ਉਹ ਜ਼ਿਆਦਾ ਪਤਲਾ ਹੈ ਜਿਵੇਂ ਕਿ ਉਸਨੂੰ ਘਿਓ ਮੱਖਣ ਲੱਸੀ ਦਹੀਂ ਅਤੇ ਇਸ ਤਰ੍ਹਾਂ ਨਾਲ ਕੁਛ ਪੋਸ਼ਨ ਖਾਣਾ ਦਿੰਦੇ ਹਾਂ ਅਤੇ ਖਾਣ ਲਈ ਮੀਟ ਇਹ ਜਿਹਾ ਕੁਛ ਪੋਸ਼ਨ ਖਾਣਾ ਦਿੱਤਾ ਜਾਂਦਾ ਹੈ ਉਸ ਨੂੰ ਜਿਵੇਂ ਸਾਡੇ ਪਿੰਡ ਇੱਕ ਬਿਲਕੁਲ ਹੀ ਪਤਲਾ ਸੀਗਾ ਮੁੰਡਾ ਅਤੇ ਉਸਨੂੰ ਖਾਣ ਪੀਣ ਵਾਸਤੇ ਇੰਨੀਆ ਚੀਜ਼ਾਂ ਦਿੱਤੀਆਂ ਗਈਆਂ ਵੱਧ ਤੋਂ ਵੱਧ ਖਾਣਾ ਖਾਣਾ ਪੀਣਾ ਚਾਹੀਦਾ ਹੈ ਅਤੇ ਆਪਣੇ ਸਰੀਰ ਦਾ ਧਿਆਨ ਬਿਲ ਪੂਰਾ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਉਸਨੇ ਆਪਣੀ ਸਿਹਤ ਦਾ ਧਿਆਨ ਵੀ ਰੱਖਿਆ ਅਤੇ ਬਿਲਕੁਲ ਇੰਨਾ ਜ਼ਿਆਦੇ ਪਤਲਾ ਸੀਗਾ ਉਸਨੂੰ ਖਾਣ ਪੀਣ ਲਈ ਇੰਨਾ ਕੁਛ ਦਿੱਤਾ ਗਿਆ ਮੀਟ ਮੱਖਣੀ ਲੱਸੀ ਦਹੀਂ ਦੁੱਧ ਅਤੇ ਇੱਦਾਂ ਨਾ ਕੁਛ ਦਿੱਤਾ ਗਿਆ ਹੈ ਨਾ ਖਾਣ ਵਾਸਤੇ ਪੰਜੀਰੀ ਖੋਏ ਦੀਆਂ ਪਿੰਨੀਆਂ ਚਾਵਲ ਦੀਆਂ ਪਿੰਨੀਆਂ ਬਣਾਈਆਂ ਜਾਂਦੀਆਂ ਨੇ ਗੀਆਂ ਅਤੇ ਕਾਜੂ ਬਦਾਮ ਮਖਾਣੇ ਅਤੇ ਛ ਹੋ ਛੋਲੇ ਅਤੇ ਇਹੋ ਜਿਹਾ ਕੁਛ ਬਹੁਤ ਕੁਛ ਖਾਣ ਨੂੰ ਦਿੱਤਾ ਜਾਂਦਾ ਹੈ ਅਤੇ ਹੁਣ ਇੰਨਾ ਜ਼ਿਆਦਾ ਵੀ ਮੋਟਾ ਵੀ ਹੋ ਗਿਆ ਅਤੇ ਵਧੀਆ ਵੀ ਲੱਗਦਾ ਗਾ ਬੱਚਾ ਬ ਜ਼ਿਆਦਾ ਵੀ ਪਤਲਾ ਨਹੀਂ ਹੋਣਾ ਚਾਹੀਦਾ ਭਾਰ ਬਿਲਕੁਲ ਸਹੀ ਹੋਣਾ ਚਾਹੀਦਾ ਹੈ ਅਤੇ ਵਧੀਆ ਸਰੀਰ ਹੋਵੇ ਤਾਂ ਜ਼ਿਆਦਾ ਸੋਹਣਾ ਵੀ ਲੱਗਦਾ ਗਾ ਲੰਮਾ ਹੋਵੇ ਅਤੇ ਭਾਰ ਵਧਾਉਣ ਵਾਸਤੇ ਆਪਣੇ 'ਚ ਜ਼ਿਆਦਾ ਤਾਂ ਪੰਜੀਰੀ ਹੀ ਪਾ ਕੇ ਦਿੱਤੀ ਜਾਂਦੀ ਹੈ ਆਪਣੇ ਪੰਜੀਰੀ ਵਿਆਹ ਸ਼ਾਦੀ ਦੇ ਮੌਕੇ 'ਤੇ ਵੀ ਕੁੜੀਆਂ ਮੁੰਡੇ ਨੂੰ ਪਾ ਕੇ ਦਿੱਤੀ ਜਾਂਦੀ ਹੈਗੀ ਅਤੇ ਭਾਰ ਵਧਾਉਂਦੇ ਹਨ ਪੰਜੀਰੀ ਪਾ ਕੇ ਦਿਤੀ ਜਾਂਦੀ ਆ ਉਹ ਪੰਜੀਰੀ ਵਿਚ ਜਿਵੇਂ ਕਿ ਡਰਾਈ ਫਰੂਟ ਸਾਰੇ ਪਾਏ ਜਾਂਦੇ ਨੇ ਕਾਜੂ ਬਦਾਮ ਇਸ ਤਰ੍ਹਾਂ ਦਾ ਕੁਛ ਖਾਣਾ ਦਿੱਤਾ ਜਾਂਦਾ ਹੈ ਭਾਰ ਵਧੀਆ ਵਧੀਆ ਸਿਹਤ ਰਹਿ ਜਾਂਦੀ ਹੈਗੀ ਪੰਜੀਰੀ ਖਾਂਦੇ ਰਹੋ ਖੋਏ ਦੀ ਪਿੰਨੀ ਚੌਲਾਂ ਦੀ ਪਿੰਨੀ ਮੂੰਗਫਲੀ ਦੇ ਦਾਣੇ ਦੀਆਂ ਪਿੰਨੀਆਂ ਬਣਾਈਆਂ ਜਾਂਦੀਆਂ ਨੇ ਗੀਆਂ ਗੁੜ ਵਾਲੀ ਗੱਚਕ ਬਣਾਈ ਜਾਂਦੀ ਹੈਗੀ